ਸਮੇਂ ਦੇ ਨਾਲ ਨਾਲ ਪੰਜਾਬੀ ਭਾਸ਼ਾ ਵਿਕਸਿਤ ਹੋਈ ਹੈ ਇਹਦਾ ਜਨਮ ਜਿਹੜਾ ਹੈ ਪ੍ਰਾਕ੍ਰਿਤ ਭਾਸ਼ਾ ਤੋਂ ਹੋਇਆ ਪਹਿਲਾਂ ਗੁਰੂ ਸਾਹਿਬ ਤੋਂ ਲੈ ਕੇ ਇਹਦੀ ਸ਼ੁਰੁਆਤ ਹੋਈ ਇਹ ਉਸ ਤੋਂ ਬਾਅਦ ਅੱਗੇ ਵਧਣੀ ਸ਼ੁਰੂ ਹੋਈ ਕਿਉਂਕਿ ਇਸ ਦੇ ਵਿੱਚ ਗੁਰੂ ਸਾਹਿਬਾਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਰਚਨਾ ਕੀਤੀ ਹੋਰ ਵੱਖ ਵੱਖ ਗ੍ਰੰਥ ਧਾਰਮਿਕ ਗ੍ਰੰਥਾਂ ਦੀ ਰਚਨਾ ਕੀਤੀ ਵਾਰਾਂ ਦੀ ਰਚਨਾ ਕੀਤੀ ਅਤੇ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਵਿਕਸਿਤ ਹੁੰਦੀ ਗਈ ਦਿਨ ਪਰ ਦਿਨ ਜਿਹੜੀ ਹੈ ਉਹ ਤਰੱਕੀ ਕਰਦੀ ਗਈ ਪੰਜਾਬ ਦੇ ਵਿੱਚ ਜਿਹੜੀ ਹੈ ਇਹ ਓਫੀਸ਼ੀਅਲ ਲੈਂਗੁਏਜ਼ ਦਫਤਰਾਂ ਦੀ ਭਾਸ਼ਾ ਹੈ ਪੰਜਾਬੀ ਪੰਜਾਬੀ ਇਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਹੋਰਾਂ ਸੂਬਿਆਂ ਦੇ ਵਿੱਚ ਵੀ ਬੋਲੀ ਜਾਂਦੀ ਹੈ ਕਾਫੀ ਪ੍ਰਚਾਰ ਹੈ ਪੰਜਾਬੀ ਬੱਚਿਆਂ ਨੂੰ ਪੜ੍ਹਾਈ ਜਾਂਦੀ ਹੈ ਇਕੱਲੇ ਭਾਰਤ ਦੇ ਵਿੱਚ ਹੀ ਨਹੀਂ ਭਾਰਤ ਦੇ ਨਾਲ ਲੱਗਦੇ ਹੋਰ ਦੇਸ਼ਾਂ ਦੇ ਵਿੱਚ ਜਿਹਨਾਂ ਵਿੱਚੋਂ ਮੁੱਖ ਰੂਪ ਦੇ ਵਿੱਚ ਕਨੇਡਾ ਹੈ ਇੰਗਲੈਂਡ ਹੈ ਉੱਥੇ ਬਹੁਤ ਸਾਰੇ ਪੰਜਾਬੀ ਰਹਿੰਦੇ ਨੇ ਜਿਹਦੇ ਕਰਕੇ ਉੱਥੇ ਪੰਜਾਬੀ ਕਾਫੀ ਵਿਕਸਿਤ ਹੋਈ ਹੈ ਉੱਥੇ ਪੰਜਾਬੀ ਭਾਸ਼ਾ ਦਾ ਕਾਫੀ ਵਿਕਾਸ ਹੋਇਆ ਹੈ ਦਫਤਰੀ ਕੰਮਾਂ ਦੇ ਵਿੱਚ ਵਰਤੋਂ ਵਿੱਚ ਲਿਆਉਂਦੀ ਜਾਣ ਲੱਗੀ ਪੰਜਾਬੀ ਭਾਸ਼ਾ ਦੇ ਨਾਲ ਇਹਦਾ ਬਹੁਤ ਵਿਕਾਸ ਹੋਇਆ ਇਹ ਵੱਡੇ ਪੱਧਰ 'ਤੇ ਬੋਲੀ ਜਾਣ ਲੱਗੀ ਸਕੂਲਾਂ ਦੇ ਵਿੱਚ ਪੜ੍ਹਾਈ ਜਾਂਦੀ ਹੈ